ਕਾਰਵਾਈ ਗੁੰਮ ਹੋਏ ਬੈਗ ਨੂੰ ਲੱਭਣ ਲਈ ਹਾਲ ਹੀ ਵਿੱਚ ਲਈ ਗਈ ਕੈਬ ਦਾ ਪਤਾ ਲਗਾਓ ਦ੍ਰਿਸ਼ ਤੁਸੀਂ ਹਾਲ ਹੀ ਵਿੱਚ ਇੱਕ ਕੈਬ ਆਟੋ ਤੋਂ ਉੱਤਰੇ ਅਤੇ ਇਸ ਵਿੱਚ ਆਪਣਾ ਮੋਬਾਇਲ ਜਾਂ ਬਟੂਆ ਭੁੱਲ ਗਏ ਤੁਸੀਂ ਆਪਣਾ ਵਾਪਿਸ ਆਉਣ ਲਈ ਕੈਬ ਡਰਾਈਵਰ ਨੂੰ ਕੌਲ ਕਰ ਸਕਦੇ ਹੋ ਜਾਂ ਆਪਣੀ ਪਿਛਲੀ ਸਵਾਰੀ ਦਾ ਪਤਾ ਲਗਾਉਣ ਲਈ ਓਬਰ ਓਲਾ ਵਰਗੀ ਐਪ ਨੂੰ ਕਹਿ ਸਕਦੇ ਹੋ